ਯਕੀਨੀ ਤੌਰ 'ਤੇ ਸਟੈਪ ਸਿੱਕੇ ਜਾਂ ਰੋਕ ਸ਼ੋਅ ਪ੍ਰਦਰਸ਼ਨੀਆਂ ਦੀ ਅਪੀਲ ਨੂੰ ਸਮਝ ਸਕਦਾ ਹੈ ਇਹ ਇਵੈਂਸ ਇਵੈਂਸਟ ਕਲੈਕਟਰਾਂ ਉਤਸ਼ਾਹੀਆਂ ਅਤੇ ਇੱਥੋਂ ਤੱਕ ਕਿ ਆਮ ਹਾਸ ਹਾਜ਼ਰੀਨ ਅਤੇ ਲਈ ਆਪਨੇ ਆਪ ਨੂੰ ਫਲੈਕਟੀ ਅੰਕ ਵਿਗਆਨ ਅਤੇ ਭੂਵਿਗਿਆਨ ਦੇ ਅਮੀਰ ਸੰਸਾਰ ਵਿੱਚ ਲੀਨ ਕਰਨ ਲਈ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦੇ ਹਨ ਸਟੈਪ ਅਤੇ ਸਿੱਕੇ ਦੇ ਸ਼ੋਅ ਵਿੱਚ ਅਕਸਰ ਦੁਰਲੱਭ ਵਸਤੂਆਂ ਸੀਮਤ ਸੰ ਸੰਸਕਰਨਾਂ ਅਤੇ ਕੀਮਤੀ ਸੰਗ੍ਰਹਿ ਸ਼ਾਮਿਲ ਹੁੰਦੇ ਹਨ ਜੋ ਲੋਕਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਆਕਰਸ਼ਿਤ ਕਰਦੇ ਹਨ ਗੰਭੀਰ ਨਿਵੇਸ਼ਕਾਂ ਤੋਂ ਲੈ ਕੇ ਆਪਣੇ ਸੰਗ੍ਰਹਿ ਨੂੰ ਵਧਾਉਣ ਦੀ ਕੋਸ਼ਿਸ਼ ਕਰਨ ਵਾਲੇ ਸ਼ੌਕੀਨਾਂ ਤੱਕ ਵਿਜ਼ਟਰ ਮਾਹਿਰਾਂ ਨੂੰ ਮਿਲ ਸਕਦੇ ਹਨ ਸੈਮੀਨਾਰਾਂ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਉਹਨਾਂ ਦੇ ਜਨੂਨ ਸਾਂਝੇ ਕਰਨ ਵਾਲੇ ਦੂਜਿਆਂ ਨੂੰ ਨੈਟਵਰਕ ਕਰ ਸਕਦੇ ਹਨ ਇਸ ਤਰ੍ਹਾਂ ਚੱਟਾਨ ਅਤੇ ਖਣਿਜ ਸ਼ੋਅ ਦੁਨੀਆ ਭਰ ਦੇ ਸੁੰਦਰ ਨਮੂਨੇ ਪ੍ਰਦਰਸ਼ਿਤ ਕਰਦੇ ਹੋਏ ਕੁਦਰਤੀ ਸੰਸਾਰ ਵਿੱਚ ਇੱਕ ਦਿਲਚਸਪ ਦ੍ਰਿਸ਼ ਪੇਸ਼ ਕਰਦੇ ਹਨ